ਵੱਖੋ ਵੱਖ ਕਿਹੜਾ ਪੰਛੀ ਕਿੱਥੇ ਰਹਿੰਦਾ ਹੈ ਹਰ ਪੰਛੀ ਆਪਣੇ ਅਲੱਗ ਅਲੱਗ ਆਲਣੇ ਵਿੱਚ ਰਹਿੰਦਾ ਹੈ ਸਭ ਦੇ ਆਲਣੇ ਇੱਕੋ ਜਿਹਾ ਹੀ ਨਹੀਂ ਰਹਿੰਦੇ ਹਨ ਕੋਈ ਅਲਣਾ ਰੁੱਖ ਦੇ ਉੱਤੇ ਬਣਾਉਂਦਾ ਹੈ ਕੋਈ ਇਮਾਰਤਾਂ ਦੇ ਉੱਤੇ ਕੋਈ ਜ਼ਮੀਨ ਦੇ ਨੇੜੇ ਆਲਣੇ ਪਕਸ਼ੀਆਂ ਲਈ ਸੁਰੱਖਿਆ ਅਤੇ ਆਰਾਮ ਦਿੰਦੇ ਹਨ ਹੰਸ ਬੱਤਕ ਜਲ ਥਲ ਇਲਾਕਿਆਂ ਵਿੱਚ ਰਹਿੰਦੀਆਂ ਹਨ ਇਹ ਆਲਣੇ ਉਦੋਂ ਤੱਕ ਬਣਾਉਂਦੇ ਹੈ ਜਦੋਂ ਤੱਕ ਉਹਨਾਂ ਦੇ ਬੱਚੇ ਜਿਹੜੇ ਹੈ ਵੱਡੇ ਨਹੀਂ ਹੋ ਜਾਂਦੇ ਘੁੱਗੀ ਕਬੂਤਰ ਅਤੇ ਹਰ ਸਾਲ ਉਹੀ ਆਲਣੇ ਵਿੱਚ ਰਹਿੰਦੇ ਹਨ ਬਾਜ਼ ਜੋ ਹੈ ਉਹ ਨਵਾਂ ਆਲਣਾ ਬਣਾਉਂਦਾ ਹੈ ਕਬੂਤਰ ਆਪਣੇ ਆਲਣੇ ਨੂੰ ਤਰਤੀਬ ਨਾਲ ਨਹੀਂ ਬਣਾਉਂਦੀ ਉਹ ਉੱਬੜ ਖਿੱਬੜ ਤਰੀਕੇ ਦੇ ਨਾਲ ਕਬੂਤਰ ਜਿਹੜਾ ਹੈ ਆਪਣੇ ਆਲਣੇ ਨੂੰ ਬਣਾਉਂਦਾ ਹੈ ਕਿੰਨੇ ਸਮੇਂ ਤੱਕ ਇੱਕੋ ਆਲਣੇ ਵਿੱਚ ਰਹਿੰਦੇ ਹਨ ਜਦੋਂ ਤੱਕ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਵੱਡੇ ਨਹੀਂ ਹੋ ਜਾਂਦੇ ਉਹਨਾਂ ਨੂੰ ਸ ਚੰਗੀ ਸੂਝ ਬੂਝ ਨਹੀਂ ਆ ਜਾਂਦੀ ਉਦੋਂ ਤੱਕ ਉਹ ਉਸੇ ਆਲਣੇ ਵਿੱਚ ਸ ਤਰੀਕੇ ਦੇ ਨਾਲ ਰਹਿੰਦੇ ਹਨ ਕੁਝ ਪੰਛੀ ਆਲਣੇ ਵਿੱਚ ਰਹਿੰਦੇ ਹਨ ਅਲੱਗ ਅਲੱਗ ਪੰਛੀ ਜਿਹੜੇ ਹੈ ਉਹ ਅਲੱਗ ਅਲੱਗ ਤਰੀਕੇ ਦੇ ਨਾਲ ਵੱਖੋ ਵੱਖ ਆਲਣਿਆਂ ਵਿੱਚ ਰਹਿੰਦੇ ਹਨ